ਸਿਰ ਦਰਦ ਦੇ ਇਲਾਜ ਲਈ ਸਾਡੇ ਪਿੰਡ ਵਿੱਚ ਇੱਕ ਕੱਲ੍ਹ ਨੌਜਵਾਨ ਬੰਦਾ ਆਇਆ ਜਿਸ ਨੇ ਸਾਨੂੰ ਦੱਸਿਆ ਕਿ ਜੇ ਕਰ ਕਿਸੇ ਦਾ ਸਿਰ ਦਰਦ ਹੁੰਦਾ ਹੋਵੇ ਤਾਂ ਫਲਾਣੀ ਦਵਾਈ ਲੈ ਲਓ ਕਿਉਂਕਿ ਉਹ ਬੰਦਾ ਦਵਾਈਆਂ ਵੇਚਦਾ ਹੈ ਅਤੇ ਉਹ ਆਪਣੀ ਦਵਾਈਆਂ ਦਾ ਪ੍ਰਚਾਰ ਕਰ ਰਿਹਾ ਸੀ ਜਿਸ ਕਰਕੇ ਉਹ ਆਪਣੀ ਰੋਜ਼ੀ ਰੋਟੀ ਕਮਾ ਸਕੇ ਪਰ ਸਾਡੇ ਪਿੰਡ ਵਿੱਚ ਸਿਆਣੇ ਬਜ਼ੁਰਗ ਕਹਿੰਦੇ ਹਨ ਕਿ ਤੁਸੀਂ ਅਗਰ ਤੁਹਾਡਾ ਸਿਰ ਦਰਦ ਹੁੰਦਾ ਹੋਵੇ ਤਾਂ ਇਸ ਤੋਂ ਬਚਣ ਲਈ ਸਾਨੂੰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਅਗਰ ਅਸੀਂ ਕਸਰਤ ਕਰਦੇ ਹਾਂ ਸਾਡਾ ਸਰੀਰ ਵੀ ਸਵਸਥ ਰਹਿੰਦਾ ਹੈ ਅਤੇ ਅਸੀਂ ਲੰਬੀ ਜ਼ਿੰਦਗੀ ਜੀਅ ਸਕਦੇ ਹਾਂ ਆਪਣੇ ਸਵਸਥ ਸਰੀਰ ਨਾਲ ਅਤੇ ਅਗਰ ਸਿਰ ਦਰਦ ਹੁੰਦਾ ਹੋਵੇ ਤਾਂ ਸਾਨੂੰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਵੀ ਇੱਕ ਵੱਡਾ ਕਾਰਣ ਹੋ ਸਕਦਾ ਹੈ ਸਿਰ ਦਰਦ ਦਾ ਜਿਸ ਕਰਕੇ ਸਾਨੂੰ ਆਪਣੇ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਖਾਣ ਪਾਣ ਵਿੱਚ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਇਸ ਕਰਕੇ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਵਰਗੀਆਂ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪਵੇ ਇਸ ਲਈ ਮੈਂ ਆ ਹੀ ਕਹਿਣਾ ਚਾਹੁੰਦ ਹਾਂ ਕੀ ਸਿਰ ਦਰਦ ਤੋਂ ਛੁਟਕਾਰਾ ਅਗਰ ਤੁਸੀਂ ਪਾਉਣਾ ਚਾਹੁੰਦੇ ਹੋ ਤੋ ਰੋਜ਼ਾਨਾ ਕਸਰਤ ਕਰਿਆ ਕਰੋ ਅਤੇ ਦਵਾਈਆਂ ਜ਼ਿਆਦਾ ਐਲੋਪੈਥਿਕ ਵਗੈਰਾ ਦਵਾਈਆਂ ਲੈਣ ਦੀ ਲੋੜ ਨਹੀਂ ਜੋ ਕਿ ਸਾਡੇ ਸਰੀਰ ਤੇ ਲੰਬੇ ਸਮੇਂ ਤੱਕ ਬਹੁਤ ਹੀ ਗਲਤ ਪ੍ਰਭਾਵ ਛੱਡਦੀਆਂ ਹਨ ਸਿਰ ਦਰਦ ਅਗਰ ਕਿਸੇ ਦਾ ਹੁੰਦਾ ਹੋਵੇ ਤਾਂ ਉਸਨੂੰ ਪ੍ਰਿਆਪਤ ਨੀਂਦ ਲੈਣ ਦੀ ਲੋੜ ਹੁੰਦੀ ਹੈ ਕਿਉਂਕਿ ਜੇ ਸਾਡੇ ਸਰੀਰ ਨੂੰ ਪ੍ਰਿਆਪਤ ਨੀਂਦ ਨਹੀਂ ਮਿਲਦੀ ਤਾਂ ਅਸੀਂ ਬਿਮਾਰ ਹੋ ਸਕਦੇ ਹਾਂ ਇਸ ਲਈ ਅਗਰ ਕਿਸੇ ਨੂੰ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਕਸਰਤ ਦੀ ਸਹਾਇਤਾ ਲਿੱਤੀ ਜਾਵੇ ਅਤੇ ਦਵਾਈਆਂ ਤੋਂ ਤਾਂ ਬੰਦੇ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਦਵਾਈਆਂ ਸਰੀਰ ਲਈ ਹਾਨੀਕਾਰਕ ਹੁੰਦੀਆਂ ਹਨ ਸਾਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਆਪਣੀ ਸਿਹਤ ਵੱਲ ਬਲੱਡ ਪ੍ਰੈਸ਼ਰ ਕਲੈਸਟ੍ਰੋਲ ਸਾਰੀਆਂ ਹੀ ਚੀਜ਼ਾਂ ਨੂੰ ਦੇਖ ਰੇਖ ਕਰਦੇ ਹੋਏ ਕਿਉਂਕਿ ਅੱਜ ਕੱਲ੍ਹ ਦੇ ਲੋਕ ਲੋਕਾਂ ਦੀ ਸਿਹਤ ਸਹੀ ਨਹੀਂ ਚੱਲ ਰਹੀ ਪੁਰਾਣੇ ਸਮਿਆਂ ਵਿੱਚ ਸਿਆਣੇ ਆਖਿਆ ਕਰਦੇ ਸਨ ਕਿ ਗਰਮ ਦੁੱਧ ਪੀਆ ਕਰੋ ਚੰਗੇ ਦੇਸੀ ਘਿਉ ਖਾਇਆ ਕਰੋ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਵੇਖਿਆ ਜਾ ਰਿਹਾ ਹੈ ਕਿ ਜੋ ਅੱਜ ਦੀਆਂ ਖੁਰਾਕਾਂ ਹਨ ਉਹ ਇੰਨੀਆਂ ਵਧੀਆਂ ਨਹੀਂ ਹੈਗੀਆਂ ਕਿਉਂਕਿ ਅੱਜ ਕੱਲ੍ਹ ਹਰ ਚੀਜ਼ ਮਿਲਾਵਟੀ ਆ ਰਹੀ ਹੈ ਸਪਰੇਟੇ ਦੁੱਧ ਆ ਰਹੇ ਹੈ ਦੂਸ਼ਿਤ ਪਾਣੀ ਆ ਰਿਹਾ ਹੈ ਅੱਗੇ ਤਾਂ ਨਲਕਿਆਂ ਵਿੱਚੋਂ ਜਿਹੜਾ ਪਾਣੀ ਨਿਕਲਦਾ ਸੀ ਉਹ ਬਹੁਤ ਹੀ ਸ਼ੁੱਧ ਹੁੰਦਾ ਸੀਗਾ ਅੱਜ ਕੱਲ੍ਹ ਦਾ ਸਾਨੂੰ ਆਰ ਓ ਦੀ ਮਦਦ ਨਾਲ ਪਾਣੀ ਫਿਲਟਰ ਕਰਨਾ ਪੈ ਰਿਹਾ ਹੈ ਇਸ ਲਈ ਇਸ ਯੁੱਗ ਵਿੱਚ ਇਹ ਟੈਂਸ਼ਨਾਂ ਟੈਂਸ਼ਨ ਜਿਹੜੀ ਹੈਗੀ ਸਟਰੈਸ ਵੇਗੈਰਾ ਇਹ ਸਿਰ ਦਰਦ ਦਾ ਬਹੁਤ ਹੀ ਵੱਡਾ ਕਾਰਨ ਯਾ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਸਭ ਤੋਂ ਵੱਡਾ ਕਾਰਨ ਅਦਾ ਕਰਦੀ ਹੈ ਜਿਸ ਵਿੱਚ ਅਵਸਾਧ ਆਉਂਦੇ ਹਨ ਅਤੇ ਕਈ ਮਾਨਸਿਕ ਬਿਮਾਰੀਆਂ ਕਰਕੇ ਵੀ ਸਿਰ ਦਰਦ ਹੁੰਦਾ ਹੈ ਇਸ ਲਈ ਸਾਨੂੰ ਜੇ ਆਪਾਂ ਖੁਸ਼ਹਾਲ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਮਾਜ ਵਿੱਚ ਵਿਚਰਨ ਦੀ ਲੋੜ ਹੈ ਜਿਹੜਾ ਬੰਦਾ ਜਾ ਕੇ ਸਮਾਜ ਵਿੱਚ ਵਿਚਰਦਾ ਹੈ ਅਤੇ ਚਾਰ ਬੰਦਿਆਂ ਨਾਲ ਆਪਦੇ ਦੁੱਖ ਸਾਂਝੇ ਕਰਦਾ ਹੈ ਉਹ ਬੰਦਾ ਕਦੇ ਵੀ ਡਿਪਰੈਸ਼ਨ ਸਿਰ ਦਰਦ ਐਂਗਜਾਇਟੀ ਜਾਂ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਰੋਗ ਦਾ ਸ਼ਿਕਾਰ ਨਹੀਂ ਬਣਦਾ ਅਤੇ ਉਹ ਬੰਦਾ ਇੱਕ ਲੰਬਾ ਜੀਵਨ ਬਤੀਤ ਕਰਦਾ ਹੈ